ਤਿੰਨ ਅਕਤੂਬਰ ਦੋ ਹਜ਼ਾਰ ਇੱਕ ਅੱਠ ਮਈ ਦੋ ਹਜ਼ਾਰ ਅੱਠ ਸਤਾਰ੍ਹਾਂ ਫਰਵਰੀ ਉੱਨੀ ਸੌ ਪਚਾਸੀ ਤੇਈ ਜੁਲਾਈ ਦੋ ਹਜ਼ਾਰ ਅੱਠ ਔਰ ਛੱਬੀ ਮਾਰਚ ਦੋ ਹਜ਼ਾਰ ਪੰਦਰ੍ਹਾਂ